ਹੈਲੋ ਤੁਸੀਂ ਸਵਿੱਗੀ ਰੈਸਟੋਰੈਂਟ ਤੋਂ ਬੋਲ ਰਹੇ ਜੇ ਮੈਂ ਤੁਹਾਨੂੰ ਨਾ ਔਨਲਾਈਨ ਔਡਰ ਕੀਤਾ ਸੀ ਅਤੇ ਉਹ ਨਾਜ਼ੁਕ ਆਈਟਮ ਜਿਹੜੀ ਸੀ ਉਹ ਆਈਸਕ੍ਰੀਮ ਸੀ ਅਤੇ ਉਹ ਆ ਤੁਹਾਡਾ ਜਿਹੜਾ ਮੇਰੇ ਕੋਲ ਔਡਰ ਸੀ ਉਹ ਬਹੁਤ ਟਾਈਮ 'ਤੇ ਪਹੁੰਚ ਗਿਆ ਸੀ ਪਰ ਜਿਹੜਾ ਉਹ ਆਈਟਮ ਸੀ ਉਹ ਸਾਰੀ ਖ਼ਰਾਬ ਹੋ ਗਈ ਅਤੇ ਆਈਸਕ੍ਰੀਮ ਜਿਹੜੀ ਉਹ ਰਸਤੇ 'ਚ ਆਉਂਦੀ ਪਿਘਲ ਗਈ ਜਿਹਦੇ ਕਰਕੇ ਉਹ ਲੀਕ ਹੋ ਗਈ ਅਤੇ ਹੁਣ ਜਦੋਂ ਮੇਰੇ ਕੋਲ ਔਡਰ ਪਹੁੰਚਿਆ ਹੈ ਅਤੇ ਉਹ ਪੂਰਾ ਖ਼ਰਾਬ ਨਿਕਲਿਆ ਅਤੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਜਿਹੜੀ ਉਹ ਆਈਸਕ੍ਰੀਮ ਆ ਜਾਂ ਤਾਂ ਉਹਨੂੰ ਬਦਲੀ ਕਰਕੇ ਦਿਓ ਅਤੇ ਜਾਂ ਮੈਨੂੰ ਜਿਹੜਾ ਪੈਸੇ ਆ ਉਹ ਵਾਪਸ ਕੀਤੇ ਜਾਣ ਵੈਸੇ ਤਾਂ ਮੈਂ ਅੱਗੇ ਜਿੰਨੀਆਂ ਵੀ ਚੀਜ਼ਾਂ ਖਰੀਦੀਆਂ ਉਹ ਸਾਰੀਆਂ ਬਹੁਤ ਵਧੀਆ ਨਿਕਲੀਆਂ ਪਰ ਇਸ ਵਾਰ ਜਿਹੜੀ ਆਹ ਤੁਹਾਡੀ ਔਡਰ ਆ ਉਹ ਸਹੀ ਨਹੀਂ ਨਿਕਲਿਆ ਇਸ ਕਰਕੇ ਮੈਂ ਸ਼ਿਕਾਇਤ ਕਰਦੀ ਹਾਂ ਕਿ ਇਹ ਮੇਰਾ ਔਡਰ ਦੇ ਜਿਹੜਾ ਉਹਦੀ ਬਦਲੀ ਕੀਤੀ ਜਾਵੇ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਇਸਨੂੰ ਈਮੇਲ 'ਤੇ ਕੰਪਲੇਂਟ ਇਹਦੀ ਪਾ ਦਿੰਦੀ ਹਾਂ ਅਤੇ ਤੁਸੀਂ ਉਹਨੂੰ ਵੇਖ ਕੇ ਪਲੀਜ਼ ਮੇਰੀ ਜਿਹੜੀ ਗੱਲ ਆ ਉਹਦੇ 'ਤੇ ਧਿਆਨ ਦਿੱਤਾ ਜਾਵੇ